ਜੀ ਇੱਦਾਂ ਐ ਕੀ ਬਣਾਈ ਸਿਖਾਈ ਦੀ ਪ੍ਰੇਰਣਾ ਤਾਂ ਮੈਨੂੰ ਮਿਲੀ ਮੇਰੀ ਮਾਂ ਕੋਲੋ ਮਾਤਾ ਜੀ ਕੋਲੋ ਮਿਲੀ ਹੈ ਕਿਉਂਕਿ ਪਹਿਲਾਂ ਦੇ ਲੋਕੀ ਜਦੋਂ ਬੁਨਾਈ ਸਿਲਾਈ ਕੜਾਈ ਇੱਦਾਂ ਦੀਆਂ ਚੀਜ਼ਾਂ ਹੀ ਕਰਦੇ ਸੀ ਤੇ ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਸੀ ਜਨਾਨੀਆਂ ਕੋਲ ਜਾਂ ਫਿਰ ਬਹੁਤ ਹੀ ਘੱਟ ਜਨਾਨੀਆਂ ਆਉਂਦੀਆਂ ਜਿਹੜੀਆਂ ਕਿ ਬਾਹਰ ਜਾ ਕੇ ਵੀ ਕੰਮ ਕਰਦੀਆਂ ਸੀ ਤੇ ਉਹਨਾਂ ਨੂੰ ਐਂ ਈ ਦੱਸਿਆ ਜਾਂਦਾ ਸੀ ਕਿ ਕੁੜੀ ਨੂੰ ਇਹ ਚੀਜ਼ ਤਾਂ ਆਣੀ ਹੀ ਚਾਹੀਦੀ ਆ ਕਿ ਅੱਗੇ ਜਾ ਕੇ ਸੋਰਿਆ ਵਿੱਚ ਉਹ ਕੰਮ ਆ ਸਕੇ ਤੇ ਮੈਨੂੰ ਕੋਈ ਖਾਸ ਮਤਲਬ ਇਹਦੇ ਵਿੱਚ ਦਿਲਚਸਪੀ ਦਿਲਚਸਪੀ ਨਹੀਂ ਸੀ ਪਰ ਫਿਰ ਵੀ ਮੇਰੀ ਮਾਤਾ ਜੀ ਨੇ ਮੈਨੂੰ ਕੋਸ਼ਿਸ਼ ਕੀਤੀ ਸਿਖਾਣ ਦੀ ਮੈਨੂੰ ਤਾਂ ਬੜੀ ਮੁਸੀਬਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਵਿੱਚ ਕਿਉਂਕਿ ਮੈਨੂੰ ਤਾਂ ਇੱਕ ਵਾਰੀ ਮੇਰੀ ਮਾਤਾ ਜੀ ਦਿਖਾਉਣ ਲੱਗੇ ਅਖਬਾਰ ਕਟਿੰਗ ਕਰਕੇ ਤੇ ਮੈਂ ਬਾਹਵਾਂ ਦੀ ਥਾਂ ਤੇ ਲੱਤਾਂ ਈ ਜੋੜਦੀਆਂ ਸੀ ਉਹ ਫਿਰ ਮਾਤਾ ਜੀ ਨੇ ਕਿਹਾ ਤੇਰੇ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਤੇ ਫੇਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਮੈਂ ਵੀ ਉਸ ਚੀਜ਼ ਨੂੰ ਸੀਰੀਅਸ ਲਿਆ ਥੋੜਾ ਜਿਹਾ ਤੇ ਤਾਂ ਕੀ ਅੱਗੇ ਜਾ ਕੇ ਮੈਨੂੰ ਕਿਸੇ ਚੀਜ਼ ਦਾ ਮਤਲਬ ਕੋਈ ਇਦਾਂ ਦੀ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੇਰੇ ਹੱਥ 'ਚ ਕੋਈ ਹੁਨਰ ਹੋਏਗਾ ਤੇ ਮੈਂ ਅੱਗੇ ਕੁਝ ਕਰ ਸਕਦੀ ਆਂ ਇਸ ਕਰਕੇ ਮੈਂ ਸਿੱਖਿਆ ਮੈਂ ਪ੍ਰੈਕਟਿਸ ਕੀਤੀ ਮੈਂ ਮਿਹਨਤ ਕੀਤੀ ਥੋੜੇ ਦਿਨਾਂ ਤੱਕ ਚਾਰ ਪੰਜ ਦਿਨ ਤੱਕ ਹਾ ਹਾ ਮੈਨੂੰ ਲੱਗ ਗਿਆ ਜੀ ਮੈਨੂੰ ਛੇ ਮਹੀਨੇ ਲੱਗ ਗਏ ਸੀ ਚੰਗੀ ਤਰ੍ਹਾਂ ਸਿਲਾਈ ਸਿੱਖਣ ਚ ਜਿਹੜੀ ਕਿ ਮੇਰੀ ਮਾਤਾ ਜੀ ਕੋਲੋ ਈ ਮੈਂ ਸਿੱਖਿਆ ਤੇ ਹੁਣ ਮੈਨੂੰ ਕਾਫੀ ਚੀਜ਼ਾਂ ਸਿਲਾਈ ਕਰਨੀਆ ਆ ਗਈਆਂ ਨੇ ਜੋ ਕਿ ਅੱਗੇ ਮੈਂ ਆਪਣੀ ਬੁਟੀਕ ਵੀ ਖੋਲ ਲਈ ਹ ਤੇ ਉਹਦਾ ਮੈਨੂੰ ਬੜਾ ਲਾਭ ਹੋਇਆ ਤੇ ਆਪਣੀ ਆਮਦਨ ਵੀ ਕਮਾਨੀ ਆ ਹੁਣ ਧੰਨਵਾਦ